ਜਦੋਂ ਅਸੀਂ ਘੁੰਮਣ ਫਿਰਨ ਜਾਂਦੇ ਹਾਂ ਤਾਂ ਕਾਫੀ ਤਰ੍ਹਾਂ ਦੇ ਸਾਨੂੰ ਤੁਰਨ ਤੋਂ ਪਹਿਲਾਂ ਧਿਆਨ ਵਿੱਚ ਰੱਖਣਾ ਪੈਂਦਾ ਹੈ ਜਿਵੇਂ ਕਿ ਅਸੀਂ ਆਪਣੀ ਵਹੀਕਲ 'ਤੇ ਜਾ ਰਹੇ ਹਾਂ ਗੱਡੀ 'ਤੇ ਗੱਡੀ ਦੀ ਸਰਵਿਸ ਸਮੇਂ ਤੋਂ ਪਹਿਲਾਂ ਆਪਣਾ ਸਮੇਂ ਸਿ ਵਧੀਆ ਕਰਾ ਲੈਣੀ ਚਾਹੀਦੀ ਹੈ ਟਾਇਰਾਂ ਦੇ ਵਿੱਚ ਹਵਾ ਦਾ ਪ੍ਰੈਸ਼ਰ ਜਿਹੜਾ ਪ੍ਰੋਪਰ ਹੋਣਾ ਚਾਹੀਦਾ ਹੈ ਜਿਹੜੀ ਸਟਿਪਣੀ ਹੈ ਉਹਨੂੰ ਵੀ ਚੈੱਕ ਕਰ ਲੈਣਾ ਚਾਹੀਦਾ ਹੈ ਅਤੇ ਆਪਣਾ ਜਿਹੜਾ ਸਟਿਪਣੀ ਵਿੱਚ ਹਵਾ ਭਰਨ ਟਾਇਰਾਂ ਵਿੱਚ ਹਵਾ ਭਰਨ ਲਈ ਜਿਹੜਾ ਪੰਪ ਹੈ ਉਹ ਵੀ ਜ਼ਰੂਰ ਹੋਣਾ ਚਾਹੀਦਾ ਹੈ ਅਤੇ ਛਤਰੀਆਂ ਹੋ ਗਈਆਂ ਵਿੰਡ ਸ਼ਟਰ ਹੋ ਗਏ ਇਹ ਵ ਵੀ ਜਿਹੜੇ ਜ਼ਰੂਰੀ ਚੀਜ਼ਾਂ ਨੇ ਇਹ ਰੱਖ ਲੈਣੇ ਚਾਹੀਦੀਆਂ ਨੇ ਹੋਰ ਜਿਵੇਂ ਰਸਤੇ ਵਿੱਚ ਖਾਣ ਪੀਣ ਲਈ ਜਿਹੜਾ ਸਮਾਨ ਹੈ ਫਲ ਫਰੂਟ ਹੋ ਗਏ ਜਾਂ ਹੋਰ ਸਨੈਕਸ ਵਗੈਰਾ ਹੋ ਗਏ ਉਹ ਵੀ ਨਾਲ ਲੈ ਲੈਣੇ ਚਾਹੀਦੇ ਨੇ ਅਤੇ ਇੱਕ ਐਮਰਜੈਂਸੀ ਲਈ ਤੁਹਾਡੇ ਕੋਲ ਜਿਹੜੇ ਟੈਂਟ ਟੈਂਟ ਕਹਿ ਲਓ ਜਾਂ ਜੋ ਮਰਜ਼ੀ ਛੋਟਾ ਤੁਹਾਡੇ ਕੋਲ ਉਹ ਵੀ ਪ੍ਰਬੰਧ ਹੋਣਾ ਚਾਹੀਦਾ ਜੇਕਰ ਤੁਹਾਨੂੰ ਕਿਤੇ ਰਿਹਾਇਸ਼ ਦਾ ਪ੍ਰਬੰਧ ਨਾ ਹੋਵੇ ਇਸ ਤਰ੍ਹਾਂ ਦੀਆਂ ਜਿਹੜੀਆਂ ਗੱਲਾਂ ਆਪਾਂ ਨੂੰ ਧਿਆਨ ਵਿੱਚ ਜ਼ਰੂਰ ਰੱਖਣੀ ਚਾਹੀਦੀਆਂ ਨੇ ਅਤੇ ਜੇ ਜ਼ਿਆਦਾ ਲੰਬਾ ਤੁਹਾਡਾ ਹੈਗਾ ਸਟਰੈਚ ਤਾਂ ਉਹਦੇ ਲਈ ਤੁਹਾਨੂੰ ਫਿਊਲ ਵੀ ਜਿਹੜਾ ਉਹ ਐਕਸਟਰਾ ਰੱਖ ਲੈਣਾ ਚਾਹੀਦਾ ਨਾਲ ਅਤੇ ਇਸ ਤਰ੍ਹਾਂ ਦੀਆਂ ਜਿਹੜੀਆਂ ਆਪਣੇ ਇਹ ਚੀਜ਼ਾਂ ਬਹੁਤ ਆਪਾਂ ਨੂੰ ਧਿਆਨ 'ਚ ਰੱਖਣੀ ਚਾਹੀਦੀਆਂ ਨੇ ਕਿਉਂਕਿ ਜਿਸ ਤਰ੍ਹਾਂ ਕਿ ਮੈਨੂੰ ਮੈਂ ਘੁੰਮਣ ਫਿਰਨ ਦਾ ਸ਼ੌਕੀਨ ਹਾਂ ਅਤੇ ਮੈਂ ਘੁੰਮਦਾ ਫਿਰਦਾ ਹੀ ਰਹਿੰਦਾ ਅਤੇ ਅਲੱਗ ਅਲੱਗ ਇਲਾਕਿਆਂ ਵਿੱਚ ਜਾਣ ਦਾ ਮੈਨੂੰ ਬਹੁਤ ਜ਼ਿਆਦਾ ਸ਼ੌਕ ਹੈ ਅਤੇ ਇਸ ਤਰ੍ਹਾਂ ਆਪਾਂ ਇਹ ਜਿਹੜੀਆਂ ਗੱਲਾਂ ਆਪਣਾ ਧਿਆਨ ਵਿੱਚ ਰੱਖਦੇ ਹੋਏ ਘੁੰਮਣ ਫਿਰਨ ਲਈ ਜਾ ਸਕਦੇ ਹਾਂ